ਕੀ ਤੁਸੀਂ ਗੁਲਸ਼ਨ ਸਵੀਟ ਹਾਊਸ ਤੋਂ ਬੋਲ ਰਹੇ ਹੋ ਮੈਂ ਤੇ ਮੇਰਾ ਪੂਰਾ ਪਰਿਵਾਰ ਬਠਿੰਡੇ ਤੋਂ ਅੰਮ੍ਰਿਤਸਰ ਦੀ ਯਾਤਰਾ ਕਰ ਰਹੇ ਸੀ ਕਿ ਰਸਤੇ ਵਿੱਚ ਮੌਸਮ ਖਰਾਬ ਹੋਣ ਦੇ ਕਾਰਨ ਸਾਡੀ ਗੱਡੀ ਮੋਗਾ ਸਥਾਨ ਤੇ ਰੁੱਕ ਗਈ ਮੈਨੂੰ ਮੇਰੇ ਫਰੈਂਡ ਨੇ ਦੱਸਿਆ ਕਿ ਇੱਥੇ ਕੋਲੇ ਹੀ ਇੱਕ ਵਧੀਆ ਰੈਸਟੋਰੈਂਟ ਹੈ ਅਸੀਂ ਉਥੋਂ ਖਾਣਾ ਆਰਡਰ ਕਰ ਸਕਦੇ ਹਾਂ ਕਿਉਂਕਿ ਅਸੀਂ ਸਵੇਰੇ ਤੋਂ ਕੁਛ ਨਹੀਂ ਖਾਧਾ ਸੀ ਅਸੀਂ ਸਵੇਰੇ ਤੋਂ ਯਾਤਰਾ ਕਰ ਰਹੇ ਸੀ ਸੋ ਮੈਂ ਤੇ ਮੇਰਾ ਪੂਰਾ ਪਰਿਵਾਰ ਭੁੱਖੇ ਸੀ ਅਸੀਂ ਸੋਚ ਰਹੇ ਸੀ ਵੀ ਕਿਤੋਂ ਖਾਣਾ ਆਰਡਰ ਕਰ ਲਈਏ ਤੇ ਮੇਰੇ ਫਰੈਂਡ ਨੇ ਤੁਹਾਡਾ ਪਤਾ ਦੱਸਿਆ ਕੀ ਉਥੋਂ ਦਾ ਖਾਣਾ ਬਹੁਤ ਵਧੀਆ ਹੈ ਉਥੋਂ ਨੌਨ ਵੈਜੀਟੇਰੀਅਨ ਅਤੇ ਵੈਜ ਦੋਨੋਂ ਖਾਣੇ ਮਿਲਦੇ ਹਨ ਤੁਸੀਂ ਬਹੁਤ ਵਧੀਆ ਖਾਣਾ ਬਣਾਉਣੇ ਹੋ ਤੇ ਉਥੇ ਸਾਫ ਸਫਾਈ ਦਾ ਵੀ ਪੂਰਾ ਧਿਆਨ ਦਿੱਤਾ ਜਾਂਦਾ ਹੈ ਮੈਂ ਤੇ ਮੇਰਾ ਪੂਰਾ ਪਰਿਵਾਰ ਉਥੋਂ ਖਾਨਾ ਮੰਗਾਉਣਾ ਚਾਹੁੰਦੇ ਹਾਂ ਅਸੀਂ ਕੀ ਤੁਸੀਂ ਸਾਨੂੰ ਇੱਥੇ ਡਿਲੀਵਰੀ ਦੇ ਸਕਦੇ ਹੋ ਗੱਡੀ ਦੇ ਵਿੱਚ ਕਿਉਂਕਿ ਮੌਸਮ ਬਹੁਤ ਖਰਾਬ ਹੈ ਜੋ ਤੁਸੀਂ ਸਾਨੂੰ ਡਿਲੀਵਰੀ ਦੇ ਸਕਦੇ ਹੋ ਖਾਣੇ ਦੀ ਇਥੋਂ ਤੱਕ ਜੇ ਦੇ ਸਕਦੇ ਹੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਅਸੀਂ ਸਵੇਰੇ ਤੋਂ ਕੁਛ ਨਹੀਂ ਖਾਧਾ ਹੈ ਸੋ ਪਲੀਜ਼